ਹੈਲੋ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਮਲਕੀਤ ਕੌਰ ਜੀ ਬੋਲ ਰਹੇ ਹੋ ਅੱਛਾ ਮੈਮ ਮੈਂ ਨਾ ਜੈਪੁਰ ਤੋਂ ਬੋਲ ਰਹੀ ਹਾਂ ਮੇਰੀ ਕਿਸੇ ਸਹੇਲੀ ਨੇ ਤੁਹਾਡਾ ਨੰਬਰ ਦਿੱਤਾ ਵੀ ਤੁਸੀਂ ਪਟਿਆਲਾ ਦੇ ਲੋਕਲ ਰਹਿਣ ਵਾਲੇ ਹੋ ਅਤੇ ਮੈਂ ਪਟਿਆਲਾ ਘੁੰਮਣਾ ਚਾਹੁੰਦੀ ਹਾਂ ਇਸ ਲਈ ਇੱਥੇ ਜਿਹੜੀਆਂ ਵੇਖਣ ਯੋਗ ਘੁੰਮਣ ਯੋਗ ਥਾਵਾਂ ਨੇ ਉਹਨਾਂ ਬਾਰੇ ਤੁਹਾਡੇ ਤੋਂ ਪੁੱਛਣਾ ਸੀ ਦੱਸ ਸਕਦੇ ਹੋ ਅੱਛਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ

ਅੱਛਾ ਠੀਕ ਹੈ ਜੀ ਹਮ ਹਮ

ਹਾਂਜੀ ਠੀਕ ਆ ਠੀਕ ਆ ਇਸ ਤਰ੍ਹਾਂ ਤਾਂ ਫਿਰ ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਵੇਖੀਆਂ ਜਾ ਸਕਦੀਆਂ ਨੇ ਪਟਿਆਲੇ ਆ ਕੇ ਠੀਕ ਹੈ ਠੀਕ ਹੈ ਚਲੋ ਠੀਕ ਹੈ ਮੈਮ ਫਿਰ ਮੈਂ ਜਦੋਂ ਵੀ ਪਟਿਆਲੇ ਆਉਣਾ ਹੋਇਆ ਤਾਂ ਮੈਂ ਤੁਹਾਨੂੰ ਦੱਸਾਂਗੀ ਅਤੇ ਫਿਰ ਤੋਂ ਤੁਹਾਡੇ ਨਾਲ ਗੱਲ ਕਰਾਂਗੀ ਅਤੇ ਤੁਸੀਂ ਮੇਰੀ ਮਤਲਬ ਥੋੜ੍ਹੀ ਮਦਦ ਕਰ ਦਿਓ ਘੁੰਮਣ ਫਿਰਨ ਦੇ ਵਿੱਚ ਓਕੇ ਜੀ ਬਹੁਤ ਬਹੁਤ ਧੰਨਵਾਦ